ਹੈਲੋ ਮੈਂ ਇੱਕ ਪਬਲਿਕ ਟੂਰ ਐਂਡ ਟਰੈਵਲ ਤੋਂ ਮੈਂ ਇੱਕ ਕੈਬ ਬੁੱਕ ਕਰੀ ਸੀਗੀ ਅਤੇ ਜਿਹੜੀ ਮੈਂ ਜਿਸ ਦਾ ਮੈਂ ਅੱਧੇ ਘੰਟੇ ਤੋਂ ਵੇਟ ਕਰ ਰਿਹਾ ਹਾਂ ਮੇਰੀ ਇੱਕ ਜੋਬ ਇੰਟਰਵਿਊ ਦਿੱਲੀ ਸੀਗੀ ਜਿਸ ਦੇ ਲਈ ਮੈਨੂੰ ਚੰਡੀਗੜ੍ਹ ਤੋਂ ਆਪਣੀ ਇੱਕ ਫਲਾਈਟ ਫੜਨੀ ਸੀਗੀ ਮੈਂ ਆਪਣੇ ਘਰ ਦੇ ਬਾਹਰ ਅੱਧੇ ਘੰਟੇ ਦਾ ਵੇਟ ਕਰ ਰਿਹਾ ਹਾਂ ਅਤੇ ਮੈਨੂੰ ਬਹੁਤ ਜ਼ਿਆਦਾ ਜਲਦੀ ਹੈ ਕਿਉਂਕਿ ਮੇਰੀ ਇੰਟਰਵਿਊ ਨਿਕਲ ਨਿਕਲਣ ਦਾ ਟਾਈਮ ਇੰਟਰਵਿਊ ਦਾ ਟਾਈਮ ਹੁੰਦਾ ਜਾ ਰਿਹਾ ਹੈ ਜਿਸ ਦੇ ਕਾਰਨ ਮੇਰੀ ਜੋ ਨੋਕ ਨੌਕਰੀ ਵੀ ਛੁੱਟ ਸਕਦੀ ਹੈ ਜੇ ਜੇ ਅਗਰ ਟਾਈਮ ਸਿਰ ਨਹੀਂ ਆ ਪਾ ਰਹੀ ਉਹ ਕੈਬ ਤਾਂ ਕੋਈ ਹੋਰ ਭਿਜਵਾ ਦਿਓ ਕਿਉਂਕਿ ਮੇਰੀ ਨੌਕਰੀ ਦਾ ਸਵਾਲ ਹੈ ਜੇ ਨਹੀਂ ਭੇਜ ਸਕਦੇ ਤਾਂ ਤੁਸੀਂ ਆਪਣਾ ਮੇਰੇ ਪੈਸੇ ਵੀ ਰਿਫੰਡ ਕਰ ਦਿਓ ਕਿਉਂਕਿ ਤੁਸੀਂ ਮੇਰੇ ਤੋਂ ਪਹਿਲਾਂ ਹੀ ਐਡਵਾਂਸ ਕਾਫੀ ਲੈ ਲਿਆ ਸੀ ਉਸਦੇ ਕਾਰਨ ਮੈਂ ਆਪਣੀ ਘਰਦਿਆਂ ਨੂੰ ਵੀ ਕੋਈ ਜਵਾਬ ਦੇਣ ਜੋਗਾ ਨਹੀਂ ਹਾਂ ਮੈਂ ਆਪਣੇ ਘਰ ਦੇ ਬਾਹਰ ਅੱਧੇ ਘੰਟੇ ਦਾ ਵੇਟ ਕਰ ਰਿਹਾ ਹਾਂ ਜੀ ਅਗਰ ਅਗਰ ਨਹੀਂ ਆਏ ਤਾਂ ਮੇਰੀ ਜੋਬ ਵੀ ਛੁੱਟ ਜਾਵੇਗੀ ਜੇ ਇਸ ਤਰ੍ਹਾਂ ਹੀ ਕਰਨਾ ਹੈ ਤਾਂ ਤੁਸੀਂ ਆਪਣੀ ਟੂਰ ਐਂਡ ਟਰੈਵਲ ਦੀ ਏਜੰਸੀ ਬੰਦ ਕਰ ਕੇ ਆਪਣੀ ਗੱਡੀਆਂ ਸਾਰੀਆਂ ਵੇਚ ਵੂਚ ਕੇ ਤੁਸੀਂ ਆਪਣੇ ਪਿੰਡ ਨੂੰ ਵਾਪਸ ਚਲੇ ਜਾਓ ਤਾਂ ਕਿ ਤੁਸੀਂ ਤੁਸੀਂ ਲੋਕਾਂ ਦੀ ਸਰਵਿਸ ਤਾਂ ਕਰ ਹੀਂ ਸਰਵਿਸ ਦੇ ਤਾਂ ਨਹੀਂ ਪਾ ਰਹੇ ਲੋਕ ਅੱਧੇ ਅੱਧੇ ਘੰਟੇ ਆਪਣੇ ਘਰ ਦੇ ਬਾਹਰ ਵੇਟ ਕਰ ਰਹੇ ਨੇ ਜਾਂ ਤੁਹਾਡੀ ਕੈਬਾਂ ਹੀ ਟ੍ਰੈਫਿਕ ਦੇ ਵਿੱਚ ਫਸਿਆ ਰਹਿੰਦੀਆਂ ਹਨ ਜਿਸ ਦੇ ਕਾਰਨ ਕੀ ਹੈ ਤੁਸੀਂ ਆਪਣਾ ਟਾਈਮ ਮੈਨੇਜਮੈਂਟ ਤਾਂ ਕਰ ਨਹੀਂ ਪਾ ਰਹੇ ਤੁਸੀਂ ਲੋਕਾਂ ਨੂੰ ਵੇਟ ਕਰਾ ਰਹੇ ਹੋ ਲੋਕ ਥੋ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਲੋਕਾਂ ਦੀ ਕੀ ਮਜ਼ਬੂਰੀ ਹੈ ਅਤੇ ਉਹਨਾਂ ਨੇ ਕਿਵੇਂ ਕਿਵੇਂ ਕੀ ਕੀ ਕਰਨਾ ਹੈ ਜੇ ਤੁਸੀਂ ਇੱਦਾਂ ਹੀ ਕਰੋਂਗੇ ਤਾਂ ਤੁਹਾਡਾ ਬਿਜ਼ਨਸ ਕਿਵੇਂ ਚੱਲ ਪਾਵੇਗਾ ਅਤੇ ਇਸ ਦੇ ਨਾਲ ਕੀ ਹੈ ਤੁਹਾਡੀ ਵੀ ਰੈਪੂਟੇਸ਼ਨ ਖ਼ਰਾਬ ਹੋ ਰਹੀ ਹੈ ਅਤੇ ਸਾਡਾ ਰਿਵਿਊ ਵੀ ਤੁਹਾਡੇ ਲਈ ਖ਼ਰਾਬ ਹੀ ਜਾਵੇਗਾ ਇਹ ਪਟਿਆਲਾ ਵਰਗਾ ਇੱਕ ਛੋਟਾ ਜਿਹਾ ਸ਼ਹਿਰ ਹੈ ਜਿਸ ਦੇ ਵਿੱਚ ਕੋਈ ਜ਼ਿਆਦਾ ਸਮਾਂ ਨਹੀਂ ਲੱਗਦਾ ਇੱਕ ਜਾਂ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਣ ਲਈ ਜ ਬਟ ਤੁਹਾਡੇ ਡਰਾਈਵਰ ਨੇ ਅੱਧਾ ਘੰਟਾ ਲਗਵਾ ਦਿੱਤਾ ਅਤੇ ਨਾਲ ਹੀ ਸਾਡਾ ਘਰ ਤੁਹਾਡੇ ਔਫ ਔਫਿਸ ਤੋਂ ਜ਼ਿਆਦਾ ਦੂਰ ਵੀ ਨਹੀਂ ਹੈ ਹਾਰਡਲੀ ਦਸ ਮਿੰਟ ਦਾ ਰਸਤਾ ਹੈ ਜਿਹੜਾ ਤੁਸੀਂ ਤੁਹਾਡਾ ਡਰਾਈਵਰ ਅੱਧੇ ਘੰਟੇ ਦੇ ਵਿੱਚ ਪੂਰਾ ਕਰ ਰਿਹਾ ਹੈ ਜੇ ਇੱਦਾਂ ਹੀ ਕਰੋਂਗੇ ਤਾਂ ਬਾਈ ਤੁਹਾਡਾ ਨਹੀਂ ਚੱਲ ਪਾਵੇਗਾ ਗੁਜ਼ਾਰਾ ਅਤੇ ਮੈਂ ਤਾਂ ਤੁਹਾਡੀ ਬਾਈ ਜਿੱਤਰੋ ਮੈਂ ਜਿਸ ਨੇ ਮੈਨੂੰ ਸੁਨੇਹਾ ਦਿੱਤਾ ਤੁਹਾਡਾ ਮੈਂ ਤਾਂ ਤੁਹਾਡੇ ਉੱਥੇ ਕੰਪਲੇਂਟ ਵੀ ਕਰ ਰਿਹਾਂ ਕਿ ਬਾਈ ਤੁਹਾਡਾ ਜਿਹੜਾ ਡਰਾਈਵਰ ਤੁਹਾਡਾ ਏਜੰਸੀ ਹੀ ਬੇਕਾਰ ਹੈ ਤੁਸੀਂ ਤਾਂ ਇਸ ਦਾ ਕੋਈ ਫਾਇਦਾ ਵੀ ਨਹੀਂ ਹੈ ਇਸ ਕਰਕੇ ਮੇਰਾ ਨਿਕਲਦਾ ਟਾਈਮ ਨਿਕਲਦਾ ਜਾ ਰਿਹਾ ਹੈ ਤਾਂ ਛੇਤੀ ਤੋਂ ਛੇਤੀ ਮੇਰੇ ਲਈ ਇੱਕ ਕੈਬ ਭਿਜਵਾ ਦਿੱਤੀ ਜਾਵੇ ਵਰਨਾ ਮੈਂ ਤੁਹਾਡੀ ਅ ਕੰਪਲੇਂਟ ਵੀ ਕਰ ਪਾ ਕਰ ਵੀ ਦੇਵਾਂਗਾ ਕੰਜ਼ੂਅਮਰ ਕੋਟ ਦੇ ਵਿੱਚ ਅਤੇ ਮੇਰੇ ਪੈਸੇ ਵੀ ਤੁਸੀਂ ਰਿਟਰਨ ਪਾਓ